ਦੋ ਲੱਖ ਇਕਾਨਵੇਂ ਹਜ਼ਾਰ ਤਿੰਨ ਸੌ ਇੱਕ ਚਾਰ ਲੱਖ ਉਨਤਾਲੀ ਹਜ਼ਾਰ ਪੰਜ ਸੌ ਦਸ ਸੱਤ ਲੱਖ ਚਾਲੀ ਹਜ਼ਾਰ ਤਿੰਨ ਸੌ ਬਾਰਾਂ ਨੌ ਲੱਖ ਪਚਵੰਜਾ ਹਜ਼ਾਰ ਦੋ ਸੌ ਤੇਰਾਂ ਪੰਜ ਲੱਖ ਇਕੱਤੀ ਹਜ਼ਾਰ ਪੰਜ ਸੌ ਦਸ